ਮੈਂ ਕੋਈ ਚਿੱਤਰਕਾਰੀ ਦੀ ਕਲਾਸ ਨਹੀਂ ਲਗਾਈ ਨਾ ਹੀ ਮੈਨੂੰ ਇਸ ਦਾ ਸ਼ੌਕ ਹੈ ਅਤੇ ਨਾ ਮੈਂ ਇਹਦੇ ਵਿੱਚ ਕੋਈ ਅਨੁਭਵ ਰੱਖਦੀ ਹਾਂ ਅਤੇ ਨਾ ਇਹਦੇ ਬਾਰੇ ਕੋਈ ਮੈਨੂੰ ਜਾਣਕਾਰੀ ਹੈ